ਮੈਨੂੰ ਬਾਗਾਂ ਦੀ ਸੈਰ ਕਰਨੀ ਬਹੁਤ ਵਧੀਆ ਲੱਗਦੀ ਸੀ ਜਦੋਂ ਵੀ ਕਿਤੇ ਬਾਗ 'ਚ ਜਾਂਦਾ ਮੈਂ ਉੱਥੇ ਬਹੁ ਬਹੁਤ ਬਹੁਤ ਚਿਰ ਉਹਨਾਂ ਫਲਾਂ ਦੇ ਲੱਦੇ ਬੂਟਿਆਂ ਨੂੰ ਵੇਖਦਾ ਰਹਿੰਦਾ ਸੀਗਾ ਅਤੇ ਉਸ ਤੋਂ ਮੈਨੂੰ ਸ਼ੌਂਕ ਸ਼ੌਂਕ ਜਾਗਿਆ ਫਿਰ ਮੈਂ ਆਪਣੇ ਘਰ ਬਗੀਚੀ ਵਿੱਚ ਫਲਾਂ ਦੇ ਬੂਟੇ ਲਗਾਏ ਜਿਸ ਤੋਂ ਮੈਨੂੰ ਬਹੁਤ ਜ਼ਿਆਦਾ ਫਲ ਫਲ ਜਲਦੀ ਹੀ ਮਿਲਣ ਦੇ ਲੱਗੇ ਲੱਗੇ ਅਤੇ ਉਸ ਤੋਂ ਪ੍ਰੇਰਿਤ ਪ੍ਰੇਰਨਾ ਲੈਂਦੇ ਹੋਏ ਮੈਂ ਇੱਕ ਬਾਗ ਪੂਰੇ ਪੂਰਾ ਸਥਾਪਿਤ ਕੀਤਾ ਜਿਸ ਵਿੱਚ ਮੈਂ ਸਮੇਂ ਸਮੇਂ 'ਤੇ ਫਲ ਆਉਣੇ ਅਤੇ ਤੋੜਨੇ ਫਲਾਂ ਦੀ ਸਾਂਭ ਸੰਭਾਲ ਕਰਨੀ ਬੂਟਿਆਂ ਦੀ ਸਾਂਭ ਸੰਭਾਲ ਕਰਨੀ ਉਹਨਾਂ ਦੀ ਗੋਡੀ ਕਰਨੀ ਪਾਣੀ ਦੇਣਾ ਬਹੁਤ ਚੰਗਾ ਲੱਗਦਾ ਸੀ ਮੈਨੂੰ ਇਸ ਇਸਦੇ ਪ੍ਰੇਰਨਾ ਸਦਕਾ ਹੀ ਮੈਂ ਇਸਨੂੰ ਇੱਕ ਬਾਗਵਾਨੀ 'ਚ ਤਬਦੀਲ ਕਰ ਲਿਆ ਅਤੇ ਬਾਗਵਾਨੀ ਹੁਣ ਬਹੁ ਬਹੁਤ ਵਧੀਆ ਉਹ ਸੀ ਇਹ ਹੀ ਮੇਰੀ ਪ੍ਰੇਰਨਾ ਸੀ ਵੀ ਇੱਕ ਚੰਗਾ ਨਾਗਰਿਕ ਹੋਣ ਦੇ ਨਾਤੇ ਮੈਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਵੀ ਪੌਦੇ ਲਗਾਵਾਂ ਅਤੇ ਉਹਨਾਂ ਤੋਂ ਆਪਣਾ ਫਲ ਫਲ ਆਦਿ ਵੀ ਪ੍ਰਾਪਤ ਕਰਾਂ ਅਤੇ ਇਸਦਾ ਕਾ ਕਾਰਨ ਈ ਕਰਕੇ ਮੈਂ ਇਹ ਸ਼ੁਰੂ ਕੀਤਾ ਇਹ ਸ਼ੌਂਕ ਸ਼ੌਂਕ ਵਿੱਚ ਮੈਨੂੰ ਬਾਗਵਾਨੀ ਦਾ ਅਜਿਹਾ ਸ਼ੌਂਕ ਪਿਆ ਅਤੇ ਇਸ ਤੋਂ ਮੈਨੂੰ ਅੱਗੇ ਪ੍ਰੇਰਨਾ ਮਿਲਦੀ ਰਹੀ ਪ੍ਰੇਰਨਾ ਦੇ ਸਦਕਾ ਮੈਂ ਹੱਲਾਸ਼ੇਰੀ ਦ ਦਿੰਦੇ ਰਹੇ ਅਤੇ ਇਸ ਦਾ ਮੈਂ ਇਕ ਬਾਗ ਸਥਾਪਿਤ ਕਰਕੇ ਅੱਜ ਮੈਂ ਇਸਨੂੰ ਬਹੁਤ ਚੰਗੇ ਵਧੀਆ ਤਰੀਕੇ ਨਾਲ ਪਾਲ ਪਾਲ ਰਿਹਾ ਹਾਂ ਅਤੇ ਇਸ ਤੋਂ ਚੰਗਾ ਫਲ ਲੈ ਰਿਹਾ ਹਾਂ ਅਤੇ ਇਸ ਤੋਂ ਚੰਗੀ ਕਮਾਈ ਵੀ ਕਰ ਕਰ ਰਿਹਾ ਹਾਂ ਤਾਂ ਇਸ ਲਈ ਇਹ ਹੀ ਮੇਰੀ ਪ੍ਰੇਰਨਾ ਸੀ ਅਤੇ ਇਹ ਹੀ ਮੇਰਾ ਬਾਗਬਾਨੀ ਦਾ ਸ਼ੁਰੂ ਕਰਨ ਦਾ ਧੰਦਾ ਸੀ ਇਸ ਇਸ ਤੋਂ ਇਲਾਵਾ ਹੋਰ ਕੋਈ ਵੀ ਅਜਿਹਾ ਨਹੀਂ ਸੀ ਇਹ ਹੀ ਮੇਰਾ ਸ਼ੁਰੂਆਤ ਸੀ